ਹੈਲੋ ਹਾਂਜੀ ਸਰ ਹਾਂਜੀ ਸੋਰੀ ਸਰ ਅਗਰ ਤੁਹਾਨੂੰ ਖਰਾਬ ਐਕਸਪੀਰੀਅੰਸ ਹੋਇਆ ਅਸੀਂ ਤਾਂ ਆਪਦੀ ਤਰਫ ਤੋਂ ਵਧੀਆ ਹੀ ਬਣਾਉਂਦੇ ਹਾਂ ਹਰ ਵਾਰੀ ਵਧੀਆ ਅਸੀਂ ਫੂਡ ਬਣਾਉਂਦੇ ਹਾਂ ਤੁਹਾਨੂੰ ਪ੍ਰੋਬਲਮ ਕੀ ਆਈ ਸੀ ਤੁਸੀਂ ਦੱਸ ਸਕਦੇ ਹੋ ਡਿਟੇਲ 'ਚ ਨਹੀਂ ਇਸ ਵਾਰੀ ਹੋ ਸਕਦਾ ਜਿਹੜਾ ਸਾਡਾ ਵਰਕਰ ਹੈਗਾ ਉਹਨੇ ਕੋਈ ਗੜਬੜ ਕਰਤੀ ਹੋਈ ਬਣਾਉਣ 'ਚ ਅਦਰਵਾਈਸ ਅਸੀਂ ਆਪਦੇ ਕਸਟਮਰ ਦੀ ਪੂਰੀ ਵੇਖਦੇ ਹਾਂ ਕਿ ਉਹਨੂੰ ਬੈਸਟ ਤੋਂ ਬੈਸਟ ਅਸੀਂ ਆਪਦਾ ਪ੍ਰ ਪ੍ਰੋਵਾਈਡ ਕਰੀਏ ਫੂਡ ਤੁਹਾਨੂੰ ਇਹੋ ਜਿਹਾ ਖਰਾਬ ਖਾਣਾ ਮਿਲਿਆ ਤਾਂ ਹੋ ਸਕਦਾ ਸੋਰੀ ਸਰ ਇਹੋ ਜਿਹਾ ਹੋਇਆ ਤੁਹਾਡੇ ਨਾਲ ਨਹੀਂ ਸਰ ਅਸੀਂ ਤਾਂ ਆਪਦੀ ਅਸੀਂ ਤਾਂ ਆਪਦੀ ਤਰਫੋਂ ਬੈਸਟ ਬਣਾਉਂਦੇ ਹਾਂ ਮਾਰਕਿਟ 'ਚ ਜਿਹੜੇ ਵੀ ਪ੍ਰਡਟਕ ਮਿਲਦਾ ਹੈ ਹੋ ਸਕਦਾ ਹੈ ਇੱਥੋਂ ਦੀ ਖਰਾਬ ਆ ਗਿਆ ਹੋ ਪਿੱਛੋਂ ਕੰਪਨੀ ਦੇ ਵੱਲੋਂ ਅਸੀਂ ਅੱਗੋਂ ਟਰਾਈ ਕਰਾਂਗੇ ਤੁਹਾਨੂੰ ਬੈਸਟ ਅਸੀਂ ਪ੍ਰੋਵਾਈਡ ਕਰੀਏ ਫੂਡ ਬਾਕੀ ਹਾਂਜੀ ਹਾਂਜੀ ਹਾਂਜੀ ਨਹੀਂ ਨਹੀਂ ਹਾਂਜੀ ਤੁਸੀਂ ਸਹੀ ਕਹਿ ਰਹੇ ਨਹੀਂ ਤਾਂ ਅੱਗੋਂ ਨਹੀਂ ਸਰ ਅਗਰ ਤੁਹਾਡੇ ਨਾਲ ਇਹੋ ਜਿਹਾ ਹੋਇਆ ਤਾਂ ਅਸੀਂ ਆਪਦਾ ਧਿਆਨ ਰੱਖਾਂਗੇ ਅਤੇ ਕੋਈ ਗੱਲ ਨਹੀਂ ਹੈ ਤੁਸੀਂ ਕੰਪਲੇਂਟ ਕਰ ਰਹੇ ਹੋ ਅਸੀਂ ਅੱਗੋਂ ਧਿਆਨ ਰੱਖਾਂਗੇ ਤੁਹਾਡੇ ਨੂੰ ਫਿਰ ਗਲਤ ਤੁਹਾਨੂੰ ਫੂਡ ਨਾ ਮਿਲੇ ਨੂਲਸ ਅਸੀਂ ਬੈਸਟ ਮੈਨ ਲੈਂਦੇ ਹਾਂ ਮਾਰਕੀਟ ਵਿੱਚ ਪਰ ਹੋ ਸਕਦਾ ਤੁਹਾਨੂੰ ਗਲਤ ਮਿਲ ਗਿਆ ਸਾਡੇ ਵਰਕਰ ਨੇ ਕੋਈ ਗਲਤੀ ਕਰਤੀ ਹੋਏ ਬਣਾਉਣ 'ਚ ਜਾਂ ਪਿੱਛੋਂ ਹੀ ਖਰਾਬ ਖਾਣਾ ਆ ਗਿਆ ਹੋਵੇ ਬਾਕੀ ਕੁਆਲਿਟੀ ਤਾਂ ਸਰ ਅਸੀਂ ਵਧੀਆ ਦੇਣ ਦੀ ਕੋਸ਼ਿਸ਼ ਕਰਦੇ ਹਾਂ ਉਹ ਤਾਂ ਸਰ ਤੁਹਾਨੂੰ ਪਤਾ ਮਹਿੰਗਾਈ ਹੋ ਗਈ ਹੈ ਮਾਰਕੀਟ ਅੰਦਰ ਦਿਨੋਂ ਦਿਨ ਰੇਟ ਵੱਧ ਰਹੇ ਨੇ ਹਰ ਇੱਕ ਪ੍ਰਡਕਟ ਦੇ ਚਾਹੇ ਪਰ ਹਾਂ ਅਗਰ ਅਸੀਂ ਰੇਟ ਹਾਂਜੀ ਅਸੀਂ ਅਗਰ ਰੇਟ ਜ਼ਿਆਦਾ ਲੈ ਰਹੇ ਹਾਂ ਤਾਂ ਸਾਨੂੰ ਅੱਛੀ ਕੁਆਲਿਟੀ ਦੇਣੀ ਚਾਹੀਦੀ ਸੋਰੀ ਤੁਹਾਨੂੰ ਖਰਾਬ ਕੁਆਲਿਟੀ ਦਾ ਖਾਣਾ ਮਿਲਿਆ ਅੱਗੋਂ ਅਸੀਂ ਵਰਕਰ 'ਤੇ ਵੀ ਅਸੀਂ ਵੇਖਾਂਗੇ ਅਗਰ ਉਹਦੇ 'ਚ ਪ੍ਰੋਬਲਮ ਆਈ ਤਾਂ ਅਸੀਂ ਉਹਨੂੰ ਚੇਂਜ ਕਰ ਦੇਵਾਂਗੇ

ਹਾਂਜੀ ਹਾਂਜੀ ਹਾਂਜੀ ਹਾਂਜੀ ਹੋ ਸਕਦਾ ਦੁੱਧ ਪਿੱਛੋਂ ਹੀ ਖਰਾਬ ਆ ਗਿਆ ਹੋਵੇ ਜਾਂ ਫਿਰ ਵਰਕਰ ਨੇ ਧਿਆਨ ਨਾ ਦਿੱਤਾ ਹੋਏ ਦੁ ਦੁੱਧ ਚੈੱਕ ਨਾ ਕਰਿਆ ਹੋਵੇ ਵੀ ਦੁੱਧ ਖਰਾਬ ਹੈ ਜਾਂ ਸਹੀ ਹੈ ਹੋ ਸਕਦਾ ਓਈਲਿੰਗ ਦੀ ਸਾਡੀ ਕੁਆਲਿਟੀ 'ਚ ਇਸ਼ੂ ਹੋ ਸਕਦੇ ਨੇ ਕਿਉਂਕਿ ਓਇਲ ਤਾਂ ਅਸੀਂ ਵੈਸੇ ਬੜੇ ਟਾਈਮ ਤੋਂ ਵਧੀਆ ਹੀ ਲੈ ਰਹੇ ਹਾਂ ਪਰ ਪਤਾ ਨਹੀਂ ਹੁੰਦਾ ਕੀ ਪਤਾ ਉਦੋਂ ਓਇਲ ਯੂਜ ਹੋ ਗਿਆ ਹੋਵੇ ਵਰਕਰ ਤੋਂ ਫਿਰ ਅਸੀਂ ਧਿਆਨ ਰੱਖਾਂਗੇ ਕਿਉਂਕਿ ਅੱਗੇ ਤਾਂ ਸਾਨੂੰ ਇਹੋ ਜਿਹੀ ਕੋਈ ਕੰਪਲੇਨ ਆਈ ਨਹੀਂ ਇਹ ਫਸਟ ਟਾਈਮ ਇਹੋ ਜਿਹਾ ਹੋਇਆ ਸਾਡੇ ਕੋਲ ਕੰਪਲੇਨ ਆ ਰਹੀ ਹੈ ਹਾਂਜੀ

ਹਾਂਜੀ ਨਹੀਂ ਨਹੀਂ ਸਰ ਹਾਂਜੀ ਅੱਗੇ ਤੋਂ ਅਸੀਂ ਧਿਆਨ ਰੱਖਾਂਗੇ ਸਰ ਸੋਰੀ ਤੁਹਾਨੂੰ ਖਰਾਬ ਖਾਣਾ ਮਿਲਿਆ ਓਕੇ ਸਰ